ਸਭ ਤੋਂ ਵੱਡੀ ਗੱਲ ਅੱਜ ਦੇ ਸਮੇਂ ਵਿੱਚ ਕੰਪਿਊਟਰ ਤੇ ਟੈਕਨੋਲੋਜੀ ਦਾ ਆਣਾ ਬਹੁਤ ਜਰੂਰੀ ਹੋ ਗਿਆ ਹੈ ਜੇਕਰ ਤੁਹਾਨੂੰ ਕੰਪਿਊਟਰ ਨਹੀਂ ਆਉਂਦਾ ਤੇ ਸਿੱਖਣਾ ਜਰੂਰੀ ਹੋ ਗਿਆ ਹੈ ਕਿਉਂਕਿ ਅੱਜ ਦੇ ਦੌਰ ਤੇ ਕੰਪਿਊਟਰ ਇੰਟਰਨੈਟ ਤੇ ਟੈਕਨੋਲੋਜੀ ਦਾ ਆਉਣਾ ਬਹੁਤ ਜਰੂਰੀ ਹੈ ਕਿਉਂਕਿ ਸਾਰੇ ਕੰਮ ਕੰਪਿਊਟਰ ਦੇ ਨਾਲ ਹੀ ਹੁੰਦੇ ਹੈ ਕਿਤੇ ਰੇਲਵੇ ਸਟੇਸ਼ਨ ਤੇ ਚਲੇ ਜਾਓ ਜਾਂ ਕਿਤੇ ਬੈਂਕ 'ਚ ਚਲੇ ਜਾਓ ਜਾਂ ਕਿਸੇ ਵੀ ਦਫਤਰਾਂ ਵਿੱਚ ਚਲੇ ਜਾਓ ਤਾਂ ਕੰਪਿਊਟਰ ਦੀ ਬਹੁਤ ਵਰਤੋਂ ਹੁੰਦੀ ਹੈ ਇਹਦੇ ਕੁਛ ਸਿੱਖਣ ਸਿੱਖਣ ਵਾਲੇ ਹੁੰਦੇ ਹਨ ਜਿਵੇਂ ਕਿ ਇਹ ਨੋਟ ਪੈਡ ਹੁੰਦੇ ਵਰਡ ਪੈਡ ਹੁੰਦੇ ਐਕਸਲ ਹੁੰਦਾ ਹੈ ਟੈਲੀ ਸਿਖਾਈ ਜਾਂਦੀ ਹੈ ਕੰਪਿਊਟਰ ਵਿੱਚ ਏਆਈਐਸ ਹੁੰਦਾ ਹੈ ਹੋਰ ਵੀ ਕੰਪਿਊਟਰ ਦੀਆਂ ਜਾਣਕਾਰੀਆਂ ਵਜੋਂ ਆਪਾਂ ਦੱਸ ਸਕਦੇ ਹਾਂ ਕਿ ਕੰਪਿਊਟਰ ਵਿੱਚ ਹੋਰ ਵੀ ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ ਅੱਜ ਕੱਲ ਤਾਂ ਕੰਪਿਊਟਰ ਦੀ ਜਰੂਰਤ ਬਹੁਤ ਬਣ ਚੁੱਕੀ ਹ ਇਸ ਦੀ ਮਹੱਤਤਾ ਹੀ ਬਹੁਤ ਹੈ ਇਸ ਕਰਕੇ ਕੰਪਿਊਟਰ ਵਿੱਚ ਜਿੱਦਾਂ ਸਾਨੂੰ ਐਕਸਲ ਵੀ ਆਉਣਾ ਡਿਜ਼ਾਇਨਿੰਗ ਕਰਨੀ ਨੋਟ ਪੈਡ ਵਰਡ ਪੈਡ ਈਮੇਲ ਜੀਮੇਲ ਵਗੈਰਾ ਵੀ ਆਉਣੀ ਬਹੁਤ ਜਰੂਰੀ ਹੈ ਇਸ ਕਰਕੇ ਸਾਨੂੰ ਕੰਪਿਊਟਰ ਕੋਰਸ ਕਰਨਾ ਚਾਹੀਦਾ ਹੈ